ਹਾਂਜੀ ਸਰ ਜੀ ਕੇ ਐਂਟਰਪਰਾਈਜੀਜ਼ ਤੋਂ ਬੋਲਦੇ ਹੋ ਮੈਂ ਨਾ ਤੁਹਾਡੇ ਤੋਂ ਮੋਬਾਈਲ ਲਿਆ ਸੀ ਜੀ ਸੈਮਸੰਗ ਦਾ ਇਹ ਜਦ ਆਇਆ ਵੀ ਬੜਾ ਲੇਟ ਮੈਨੂੰ ਔਡਰ ਕੀਤਿਆਂ ਨੂੰ ਤਾਂ ਕਿੰਨੇ ਦਿਨ ਹੋ ਗਏ ਅਤੇ ਇਹ ਤਾਂ ਪੰਜ ਛੇ ਦਿਨ ਲੇਟ ਆਇਆ ਜਦੋ ਮੈਂ ਬੋਕਸ ਖੋਲਿਆ ਇਹਦੇ 'ਚ ਤਾਂ ਸਕਰੈਂਚ ਹੀ ਬੜੇ ਹੈ ਪਤਾ ਨਹੀਂ ਤੁਸੀਂ ਪੁਰਾਣਾ ਜਿਹਾ ਸੈੱਟ ਕੋਈ ਪਾ ਕੇ ਵਿੱਚ ਭੇਜ ਤਾ ਹੈ ਮੈਂ ਮੈਂ ਨਹੀਂ ਇਹ ਰੱਖਣਾ ਜੀ ਇਹ ਤਾਂ ਮੈਂ ਵਾਪਸ ਹੀ ਕਰਨਾ ਚਾਹੁੰਦੀ ਹਾਂ ਅਤੇ ਤੁਸੀਂ ਮੈਨੂੰ ਦੱਸੋ ਕੀ ਪਰੋਸੀਜ਼ਰ ਹੈ ਮੈਂ ਵਾਪਸ ਕਰਨਾ ਚਾਹੁੰਦੀ ਹਾਂ ਜੀ